ਪਹਿਲੇ ਸਮਿਆਂ ਦੇ ਵਿੱਚ ਇੱਕ ਜਣਾ ਢੋਲ ਵਜਾਉਂਦਾ ਹੈ ਅਤੇ ਛੇ ਜਣੇ ਨੱਚਦੇ ਹਨ ਅਤੇ ਭੰਗੜਾ ਪਾਉਂਦੇ ਹਨ ਭੰਗੜਾ ਪਾਉਣ ਸਮੇਂ ਜੋ ਪ੍ਰ ਪ੍ਰਦਰਸ਼ਨ ਕਰਨ ਸਮੇਂ ਜੋ ਪਹਿਨਿਆ ਪਹਿਰਾਵਾ ਪਹਿਨਿਆ ਜਾਂਦਾ ਹੈ ਉਹ ਹੈ ਕੁੜਤਾ ਅਤੇ ਚਾਦਰਾ ਕੁੜਤਾ ਹੁੰਦਾ ਹੈ ਗੋਡਿਆਂ ਤੱਕ ਅਤੇ ਚਾਦਰਾ ਚਾਦਰੇ ਦਾ ਖੇਤਰਫਲ ਵੱਡਾ ਹੁੰਦਾ ਹੈ ਚਾਦਰਾ ਬੰਨ੍ਹ ਕੇ ਪੰਜਾਬੀ ਕੁੜਤਾ ਚਾਦਰਾ ਬੰਨ੍ਹ ਕੇ ਪੰਜਾਬੀ ਭੰਗੜਾ ਪਾਉਂਦੇ ਹਨ ਅਤੇ ਤਾਂ ਕਿ ਲੋਕ ਨੱਚਦੇ ਟੱਪਦੇ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਉੱਠਦੇ ਬਹਿੰਦਿਆਂ ਕੋਈ ਪਰੇਸ਼ਾਨੀ ਨਾ ਹੋਵੇ ਪਹਿਲਿਆਂ ਸਮੇਂ ਦੇ ਵਿੱਚ ਭੰਗੜਾ ਪਾਇਆ ਜਾਂਦਾ ਸੀ ਅੱਜ ਦੇ ਸਮੇਂ ਦੇ ਵਿੱਚ ਭੰਗੜਾ ਕੁੜਤੇ ਪਜਾਮੇ ਦੇ ਵਿੱਚ ਵੀ ਪਾਇਆ ਜਾਂਦਾ ਹੈ ਜੀਨ ਅਤੇ ਕੁੜਤੇ ਨਾਲ ਵੀ ਪਾਇਆ ਜਾਂਦਾ ਹੈ ਭੰਗੜਾ ਪਾਉਣ ਦੇ ਵੱਖ ਵੱਖ ਡਰੈਸ ਤਿਆਰ ਹੋਈਆਂ ਹਨ ਕੁੜਤੇ ਚਾਦਰੇ ਅਤੇ ਪੌਸ਼ਾਕ ਵੀ ਪਾਈ ਜਾਂਦੀ ਹੈ ਜਿਵੇਂ ਕਿ ਹਾਫ਼ ਬਾਜੂ ਜੈਕਟ ਪਾ ਕੇ ਅਤੇ ਕੁੜਤੇ ਦੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਪ੍ਰਦਰਸ਼ਨ ਕੀਤਾ ਜਾਂਦਾ ਹੈ ਅਤੇ ਇਹ ਦੋ ਮੁੱਖ ਪਹਿਰਾਵੇ ਹਨ ਕੁੜਤਾ ਚਾਦਰਾ ਅਤੇ ਕੁੜਤਾ ਪਜਾਮਾ ਇਹ ਦੋ ਮੁੱਖ ਪਹਿਰਾਵੇ ਹਨ ਜਿਸ ਦੇ ਨਾਲ ਭੰਗੜਾ ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਪਹਿਰਾਵਾ ਪਹਿਨਿਆ ਜਾਂਦਾ ਹੈ ਪ੍ਰੰਤੂ ਕਈ ਪਹਿਰਾਵੇ ਅੱਜ ਕੱਲ੍ਹ ਜੀਨ ਦੇ ਨਾਲ ਕੁੜਤਾ ਕੁੜਤਾ ਪਾ ਕੇ ਵੀ ਕੀਤੇ ਜਾਂਦੇ ਹਨ ਅੱਜ ਕੱਲ੍ਹ ਇਹ ਚੀਜ਼ਾਂ ਆਮ ਜੀਆਂ ਹੋ ਚੁੱਕੀਆਂ ਹਨ ਪਰ ਪਹਿਲੇ ਸਮੇਂ ਭੰਗੜੇ ਦੀ ਬਹੁਤ ਜ਼ਿਆਦਾ ਕਦਰ ਅਤੇ ਸਨਮਾਨ ਹੁੰਦਾ ਸੀਗਾ ਹਰ ਇੱਕ ਚੀਜ਼ ਇੱਕ ਲਹਿਜੇ ਨਾਲ ਪਾਈ ਜਾਂਦੀ ਸੀ ਅਤੇ ਭੰਗੜੇ ਦੇ ਵਿੱਚ ਵਰਤੀ ਜਾਂਦੀ ਸੀ